ਜ਼ਿੰਦਗੀ ਹੋਵੇ ਨੌਕਰੀ ਹੋਵੇ ਕੈਰੀਅਰ ਜਾਂ ਫਿਊਚਰ ਭਵਿੱਖ ਹਰ ਬੰਦਾ ਸਕੂਨ ਭਾਲਦਾ ਹੈ ਤਾਂ ਬਸ ਇਹੀ ਹੈ ਕਿ ਜਿੱਥੇ ਵੀ ਕੰਮ ਕਰੀਏ ਆਪਣੀ ਲਗਨ ਨਾਲ ਕਰੀਏ ਜਿੰਨਾਂ ਮਿਹਨਤ ਕਰਦੇ ਹਾਂ ਉਹਨਾਂ ਸਾਨੂੰ ਰਿਫੰਡ ਵੀ ਮਿਲੇ ਹੈ ਨਾ ਰਿਵਾਰਡਸ ਵੀ ਮਿਲਣ ਤਾਂ ਇੱਕ ਸਕੂਨ ਹੋਣਾ ਚਾਹੀਦਾ ਹੈ ਫਿਊਚਰ ਦੇ ਵਿੱਚ ਵੀ ਕਾਫੀ ਸਾਰੇ ਪੇਪਰਾਂ ਦੀ ਪ੍ਰੇਪਰੇਸ਼ਨ ਕਰ ਵੀ ਰਹੇ ਹਾਂ ਫਿਲਹਾਲ ਵੀ ਜੋਬ 'ਤੇ ਹਾਂ ਅਸਿਸਟੈਂਟ ਪ੍ਰੋਫੈਸਰ ਤਾਂ ਸੈਟਿਸਫਾਈ ਹਾਂ ਤਾਂ ਬਸ ਸੈਟਿਸਫਾਈ ਹੀ ਰਹਿਣਾ ਚਾਹੁੰਦੇ ਹਾਂ ਸਕੂਨ ਭਾਲਦੇ ਹਾਂ